ਰਵਾਇਤੀ ਪਕਵਾਨਾਂ ਦੀ ਗੱਲ ਕਰੀਏ ਤਾਂ ਸਰਦੀਆਂ ਦਾ ਇੱਕ ਪੰਜਾਬੀਆਂ ਦਾ ਮਸ਼ਹੂਰ ਪਕਵਾਨ ਗੁੜ ਦੀਆਂ ਪਿੰਨੀਆਂ ਹਨ ਜਿਸ ਨੂੰ ਬਣਾਉਣ ਦੀ ਸਮੱਗਰੀ ਸਮੱਗਰੀ ਕੁੱਝ ਇਸ ਪ੍ਰਕਾਰ ਹੈ ਮਾਵਾ ਗੁੜ ਕਾਜੂ ਬਦਾਮ ਆਦਿ ਅਤੇ ਦੇਸੀ ਘਿਓ ਇਸ ਸਭ ਦੇ ਮਿਸ਼ਰਨ ਨਾਲ ਇੱਕ ਇਸ ਸਭ ਦੇ ਮਿਸ਼ਰਨ ਨਾਲ਼ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਖਾਣ ਵਿੱਚ ਬਹੁਤ ਲਾਹੇਵੰਦ ਅਤੇ ਸਵਾਦਇਸ਼ਟ ਹੁੰਦੀਆਂ ਹਨ ਅਤੇ ਸਾਡੇ ਪੰਜਾਬੀ ਇਸ ਨੂੰ ਬਹੁਤ ਸਵਾਦ ਅਤੇ ਚਾਅ ਨਾਲ ਖਾਂਦੇ ਹਨ ਇਸ ਨੂੰ ਦਵਾਈ ਵਜੋਂ ਵੀ ਬਹੁਤੇ ਲੋਕ ਇਸ ਨੂੰ ਦਵਾਈ ਵਜੋਂ ਵੀ ਖਾਂਦੇ ਹਨ